ਜਿਹੜੀ ਮੈਂ ਸਨਸਕ੍ਰੀਮ ਲਈ ਸੀ ਉਂਝ ਤਾਂ ਉਹ ਵਧੀਆ ਸੀ ਪਰ ਉਸਦਾ ਜਿਹੜਾ ਪ੍ਰਾਈਜ਼ ਸੀ ਉਹ ਬਹੁਤ ਜ਼ਿਆਦਾ ਹਾਈ ਸੀ ਕਿਉਂਕਿ ਮੈਂ ਜਦੋਂ ਦੂਜੀ ਵਾਰੀ ਖਰੀਦਣ ਗਈ ਤਾਂ ਉਸਦਾ ਪ੍ਰਾਈਜ਼ ਉਸ ਨਾਲੋਂ ਦੁੱਗਣਾ ਸੀ ਕਿਉਂਕਿ ਪਹਿਲੇ ਤਾਂ ਮੈਂ ਡਿਸਕਾਊਂਟ ਨਾਲ ਖਰੀਦੀ ਹੋਈ ਸੀ ਅਤੇ ਉਸ ਨਾਲ ਮੇਰੇ ਫੇਸ 'ਤੇ ਇਫੈਕਟ ਤਾਂ ਹੋਇਆ ਪਰ ਜਦੋਂ ਮੈਂ ਉਹ ਕਰੀਮ ਲਗਾਉਣੀ ਛੱਡ ਦਿੱਤੀ ਉਹ ਤੋਂ ਬਾਅਦ ਮੇਰਾ ਫੇਸ ਦੁਬਾਰਾ ਡੱਲ ਹੋਣਾ ਸ਼ੁਰੂ ਹੋ ਗਿਆ ਅਤੇ ਚਿਹਰੇ 'ਤੇ ਚਿਪਚਿਪਾਹਟ ਹੋਣੀ ਸਟਾਰਟ ਹੋ ਗਈ